ਸੈਲਫ ਹੈਲਪ ਗਰੁੱਪ ਜਿਹੜੇ ਹਨ ਉਹ ਆਪਣੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੋ ਰਹੇ ਹਨ ਜਿਹਦੇ ਵਿੱਚ ਕਿ ਔਰਤਾਂ ਇੱਕ ਦੂਸਰੇ ਦੀ ਮਦਦ ਕਰ ਰਹੀਆਂ ਹਨ ਉਹ ਸਾਰੇ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ ਦਸ ਤੋਂ ਪੰਦਰਾਂ ਲੇਡੀਜ਼ ਦਾ ਔਰਤਾਂ ਦਾ ਇੱਕ ਗਰੁੱਪ ਬਣਾ ਕੇ ਉਹ ਆਪਣੇ ਪੈਸੇ ਇਕੱਠੇ ਕਰਕੇ ਜੋ ਵੀ ਥੋੜ੍ਹਾ ਥੋੜ੍ਹਾ ਹੁੰਦਾ ਆ ਇਕ ਦੂਸਰੇ ਨੂੰ ਆਪਣੇ ਫਾਈਨੈਂਸ਼ੀਅਲੀ ਸਪੋਰਟ ਕਰਦੀਆਂ ਹਨ ਜਿਹਦੇ ਵਿੱਚ ਜੇ ਕਿਸੇ ਨੇ ਕੋਈ ਛੋਟਾ ਮੋਟਾ ਰੋਜ਼ਗਾਰ ਖੋਲ੍ਹਣਾ ਹੋਵੇ ਤਾਂ ਅੱਠ ਦਸ ਜਨਾਨੀਆਂ ਜਿਹੜੀਆਂ ਬੀਬੀਆਂ ਆਪਣੀਆਂ ਇਕੱਠੀਆਂ ਹੋ ਕੇ ਪੈਸਾ ਇਕੱਠਾ ਕਰਕੇ ਉਸ ਇੱਕ ਔਰਤ ਨੂੰ ਦਿੰਦੇ ਦਿੰਦੀਆਂ ਹਨ ਜਿ ਜਿਹਦੇ ਨਾਲ ਉਹ ਇਹ ਆਪਣਾ ਕੰਮ ਸ਼ੁਰੂ ਕਰ ਸਕੇ ਅਤੇ ਬਾਅਦ 'ਚ ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਇੱਕ ਬਹੁਤ ਛੋਟੀ ਅਮਾਊਂਟ ਹੁੰਦੀ ਹੈ ਜਿਹੜੀ ਕਿ ਸਾਰਿਆਂ ਨੇ ਇਕੱਠੇ ਕੀਤੀ ਹੁੰਦੀ ਉਹ ਜਿਹੜੀ ਦੂਸਰੀ ਬੀਬੀ ਹੈ ਉਹ ਵੀ ਆਪਣਾ ਇੱਕ ਛੋਟਾ ਜਿਹਾ ਹਿੱਸਾ ਪਾ ਕੇ ਬਾਕੀ ਸਾਰਿਆਂ ਦਾ ਜਿਹੜਾ ਆਪਣਾ ਪੈਸੇ ਹੈ ਵਾਪਸ ਕਰ ਦਿੰਦੀ ਹੈ ਥੋੜ੍ਹੇ ਥੋੜ੍ਹੇ ਕਰਕੇ ਇਹਦੇ ਨਾਲ ਕੀ ਹੁੰਦਾ ਕਿ ਉਹਦੇ ਉਹਨਾਂ 'ਤੇ ਕੋਈ ਜ਼ਿਆਦਾ ਭਾਰ ਨਹੀਂ ਪੈਂਦਾ ਬੀਬੀਆਂ 'ਤੇ ਪੈਸੇ ਇਕੱਠੇ ਕਰਨ ਦਾ ਜਾਂ ਕਿਤੋਂ ਆਪਣਾ ਇਨਵੈਸਟਮੈਂਟ ਦੇਖਣ ਦਾ ਕਿ ਕਿਤੋਂ ਜ਼ਿਆਦਾ ਪੈਸੇ ਲੈ ਕੇ ਆਉਂਦੀਆ ਕਿੱਦਾਂ ਨਾ ਕਰਨ ਇਹਦੇ ਨਾਲ ਉਹਨਾਂ ਨੂੰ ਇਹ ਸਹੂਲਤ ਹੋ ਗਈ ਕਿ ਉਹ ਆਪਣੇ ਜੇ ਕੋਈ ਰੋਜ਼ਗਾਰ ਛੋਟਾ ਮੋਟਾ ਕਰਨਾ ਚਾਹੁੰਦੀਆਂ ਹਨ ਅਤੇ ਰਲ ਮਿਲ ਕੇ ਆਪਣਾ ਸੈਲਫ ਹੈਲਪ ਗਰੁੱਪ ਦੇ ਥਰੂ ਕਰ ਸਕਦੀਆਂ ਹਨ ਉਹ ਇੱਕ ਦੂਸਰੇ ਦਾ ਹੱਥ ਵਟਾਉਂਦੀਆਂ ਹਨ ਅਤੇ ਆਪਣਾ ਖਰਚਾ ਸਾਂਭ ਲੈਂਦੇ ਹਨ ਆਪਣੇ ਛੋਟੇ ਛੋਟੇ ਇਨਵੈਸਟਮੈਂਟ ਦੇ ਨਾਲ ਹੀ